ਸਾਡੀ ਜ਼ਿੰਦਗੀ ਦੇ ਵਿੱਚ ਉੱਦਾਂ ਤਾਂ ਛੋਟੀਆਂ ਛੋਟੀਆਂ ਜਿਹੜੀਆਂ ਚੁਣੌਤੀਆਂ ਹੈ ਹਮੇਸ਼ਾ ਹੀ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਚੁਣੌਤੀ ਜਿਹੜੀ ਕਿ ਮੈਨੂੰ ਹੁਣ ਯਾਦ ਹੈ ਜਿਸ ਨੂੰ ਯਾਦ ਕਰਕੇ ਮੈਂ ਹੁਣ ਹੱਸਦੀ ਵੀ ਹਾਂ ਉਹ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਸਾਡੇ ਕੋਲਿਜ ਦੇ ਵਿੱਚ ਇੱਕ ਫੰਕਸ਼ਨ ਹੈ ਇੱਕ ਈਵੈਂਟ ਹੈ ਜਿਹੜਾ ਕਿ ਅਸੀਂ ਔਰਗਨਾਈਜ਼ ਕਰਵਾਇਆ ਸੀਗਾ ਜਿਹੜਾ ਕਿ ਤੀਜ ਦਾ ਪ੍ਰੋਗਰਾਮ ਸੀਗਾ ਤੀਆਂ ਦਾ ਤਿਉਹਾਰ ਜਿਹੜੀਆਂ ਸਾਡੇ ਅਧਿਆਪਕ ਸਾਹਿਬਾਨ ਸੀ ਅਤੇ ਜਿਹੜੀਆਂ ਸਾਡੇ ਕੋਲਿਜ ਦੀਆਂ ਵਿਦਿਆਰਥਣਾਂ ਸੀ ਉਹਨਾਂ ਸਭ ਨੇ ਮਿਲ ਕੇ ਮਨਾਇਆ ਸੀ ਤਾਂ ਉਸ ਦੇ ਵਿੱਚ ਮੈਨੂੰ ਜਿਹੜਾ ਕਿ ਸਟੇਜ ਹੈਂਡਲ ਕਰਨ ਦਾ ਮੌਕਾ ਮਿਲਿਆ ਸੀ ਉਸ ਦੇ ਵਿੱਚ ਸਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਜ਼ਿਆਦਾ ਵਧੀਆ ਜਾ ਰਿਹਾ ਸੀ ਸਾਡੇ ਗੈਸਟ ਬਾਰਹੋਂ ਵੀ ਆਏ ਸਨ ਅਤੇ ਸਾਡੇ ਜਿਹੜੇ ਕੋਲਿਜ ਦੇ ਪ੍ਰਿੰਸੀਪਲ ਨੇ ਡਾਕਟਰ ਮੋਨੀਕਾ ਸ਼ਰਮਾ ਮੈਮ ਉਹ ਵੀ ਆਏ ਹੋਏ ਸੀ ਸਨ ਅਤੇ ਹੋਰ ਵੀ ਸਾਡੇ ਬਹੁਤ ਸਾਰੇ ਟੀਚਰ ਜਿਹੜੇ ਸੀਗੇ ਸਾਡੇ ਨਾਲ਼ ਜੁੜੇ ਹੋਏ ਸਨ ਅਤੇ ਉਹਦੇ ਵਿੱਚ ਜਦੋਂ ਮੈਂ ਸਟੇਜ ਹੈਂਡਲ ਕਰ ਰਹੀ ਤੀ ਸੀ ਤਾਂ ਸਾਰੇ ਹੀ ਸਾਨੂੰ ਬਹੁਤ ਜ਼ਿਆਦਾ ਚੇਅਰ ਕਰ ਰਹੇ ਸੀ ਬਹੁਤ ਵਧੀਆ ਮਾਹੌਲ ਸੀ ਸਾਰੇ ਬੜੇ ਹੀ ਇੰਨਜੋਏ ਕਰ ਰਹੇ ਸੀਗੇ ਉਸ ਫੰਕਸ਼ਨ ਨੂੰ ਤਾਂ ਉਸ ਦੇ ਵਿੱਚ ਲਾਸਟ ਦੇ ਵਿੱਚ ਜਿਹੜੀ ਮੇਰੇ ਤੋਂ ਇੱਕ ਗ਼ਲਤੀ ਉਹ ਇਹ ਹੋ ਗਈ ਸੀ ਕਿ ਜਦੋਂ ਅਸੀਂ ਮਿਸ ਤੀਜ ਉਸ ਦੇ ਵਿੱਚ ਚੂਸ ਕਰਨਾ ਸੀ ਮਿਸ ਤੀਜ ਦਾ ਜਿਹੜਾ ਕਿ ਖਿਤਾਬ ਹੈ ਉਹ ਕਿਸੇ ਟੀਚਰ ਨੂੰ ਦੇਣਾ ਸੀ ਤਾਂ ਸਾਡੇ ਉਦੋਂ ਇੱਕ ਜਿਹੜੇ ਟੀਚਰ ਦਾ ਨਾਮ ਸੀ ਉਹ ਵਿਨਰ ਦਾ ਨਾਮ ਮੇਰੇ ਤੋਂ ਗ਼ਲਤ ਅਨਾਊਂਸ ਹੋ ਗਿਆ ਸੀ ਅਤੇ ਜਿਹੜੇ ਟੀਚਰ ਸੀ ਜਿਹਨਾਂ ਦਾ ਨਾਮ ਮੈਂ ਬੋਲ ਦਿੱਤਾ ਸੀ ਉਹ ਜਦੋਂ ਸਟੇਜ 'ਤੇ ਆਏ ਅਤੇ ਉਹਨਾਂ ਨੂੰ ਉਦੋਂ ਜਦੋਂ ਪਤਾ ਲੱਗਿਆ ਕਿ ਇਹ ਮੇਰਾ ਜਿਹੜਾ ਕਿ ਇਹ ਕੋਂਪੀਟੀਸ਼ਨ ਹੈ ਜਾਂ ਜਿਹੜਾ ਖਿਤਾਬ ਹੈ ਕਿਸੇ ਹੋਰ ਟੀਚਰ ਦਾ ਹੈ ਇਹ ਮੈਨੂੰ ਨਹੀਂ ਮਿਲਿਆ ਤਾਂ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ਼ ਇਸ ਚੀਜ਼ ਨੂੰ ਹੈਂਡਲ ਕੀਤਾ ਅਤੇ ਉਹਨਾਂ ਨੇ ਮੈਨੂੰ ਵੀ ਬਹੁਤ ਹੀ ਜ਼ਿਆਦਾ ਸਹਾਰਾ ਦਿੱਤਾ ਹੌਂਸਲਾ ਦਿੱਤਾ ਅਤੇ ਜਿਹੜੇ ਟੀਚਰ ਜਿਹੜੇ ਕਿ ਅਸਲ ਦੇ ਵਿੱਚ ਇਸ ਖਿਤਾਬ ਦੇ ਜਿਹਨਾਂ ਨੂੰ ਇਹ ਖਿਤਾਬ ਮਿਲਿਆ ਸੀ ਤਾਂ ਉਹਨਾਂ ਨੂੰ ਉਨ੍ਹਾਂ ਨੇ ਸਟੇਜ ਦੇ ਉੱਤੇ ਬੁਲਾਇਆ ਅਤੇ ਜਿਹੜਾ ਆਪਣਾ ਕਰਾਊਨ ਸੀਗਾ ਅਤੇ ਆਪਣੀ ਜਿਹੜੀ ਫੁੱਲਕਾਰੀ ਸੀ ਉਹਨਾਂ ਨੇ ਉਹ ਵਾਲੇ ਟੀਚਰ ਜਿਹੜੇ ਕਿ ਜਿੱਤੇ ਸਨ ਉਹਨਾਂ ਨੂੰ ਦਿੱਤੀ ਅਤੇ ਮੈਨੂੰ ਵੀ ਬਹੁਤ ਹੀ ਜ਼ਿਆਦਾ ਉਹਨਾਂ ਨੇ ਪਿਆਰ ਦੇ ਨਾਲ਼ ਅਸ਼ੋਰ ਕੀਤਾ ਅਤੇ ਇਸ ਤਰ੍ਹਾਂ ਸਾਡੀ ਜਿਹੜੀ ਆਪਾਂ ਉਹ ਸਿਚੁਏਸ਼ਨ ਹੈ ਉਸ ਨੂੰ ਡੀਲ ਕੀਤਾ